ਜਿਵੇਂ ਕਿ ਪੰਜਾਬ ਨੂੰ ਪੰਜ ਨਦੀਆਂ ਦਾ ਪਰਦੇਸ਼ ਮੰਨਿਆ ਗਿਆ ਹੈ ਇਸ ਅਧਾਰ 'ਤੇ ਪੰਜਾਬ ਦੇ ਵਿੱਚ ਜਿਹੜਾ ਖੇਤੀਬਾੜੀ ਉਦਯੋਗ ਹੈ ਉਹ ਸਭ ਤੋਂ ਜ਼ਿਆਦਾ ਪ੍ਰਚੱਲਿਤ ਹੁੰਦਾ ਹੈ ਪਰ ਤਰੱਕੀ ਅਤੇ ਟੈਕਨੋਲਜੀ ਦੇ ਨਾਲ ਨਾਲ ਪੰਜਾਬ ਇਕੱਲੇ ਖੇਤੀਬਾੜੀ 'ਚ ਹੀ ਨਹੀਂ ਜਦੋਂ ਕਿ ਹੁਣ ਆਪਣੇ ਸਪੋਰਟਸ ਮਾਰਕੀਟ ਅਤੇ ਇਹ ਤੋਂ ਇਲਾਵਾ ਹੋਰ ਬਥੇਰੀਆਂ ਆਪਣੇ ਉਦਯੋਗ ਖੇਤਰਾਂ ਕਰਕੇ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਹੈ ਪੰਜਾਬ ਦੇ ਵਿੱਚ ਆਪਾਂ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਸਪੋਰਟਸ ਦੇ ਜਿਹੜੇ ਸ ਉਦਯੋਗ ਹਨ ਉਹ ਜ਼ਿਆਦਾ ਗਰੋ ਕਰ ਰਹੇ ਹਨ ਜਿਹਦੇ ਨਾਲ ਕਿ ਪੰਜਾਬ ਆਪਣੀ ਇਹ ਅਲੱਗ ਪਹਿਚਾਣ ਬਣਾ ਰਿਹਾ ਜਿੱਥੇ ਕਿ ਪੰਜਾਬ ਪਹਿਲਾਂ ਖੇਤੀਬਾੜੀ ਦੇ ਉਦਯੋਗ ਦੇ ਵਿੱਚ ਸਭ ਤੋਂ ਨੰਬਰ ਵਨ ਹੁੰਦਾ ਸੀ ਹੁਣ ਉਹ ਖੇਤੀਬਾੜੀ ਦੇ ਨਾਲ ਨਾਲ ਹੋਰ ਬਥੇਰੇ ਦੂਸਰੇ ਉਦਯੋਗ ਜਿਵੇਂ ਕਿ ਸਾਇੰਸ ਐਂਡ ਟੈਕਨੋਲੋਜੀ ਅਤੇ ਹੋਰ ਸ ਆਈ ਟੀ ਸਰਵਿਸਿਸ ਦੇ ਨਾਲ ਨਾਲ ਆਪਣੇ ਜਿਹੜੇ ਸਪੋਰਟਸ ਸਪੋਰਟਸ ਅਤੇ ਐਕਸਰਸਾਈਜ਼ ਅਤੇ ਮਟੀਰੀਅਲ ਵਗੈਰਾ ਦੀਆਂ ਫੈਕਟਰੀਆਂ ਐਕਸਪੋਰਟ ਕਰ ਰਿਹਾ ਹੈ ਉਹ ਇਕੱਲੇ ਇੰਡੀਆ ਤੋਂ ਆਉਂਦਾ ਨਹੀਂ ਨਹੀਂ ਜਦੋਂ ਕਿ ਇੰਡੀਆ ਦੇ ਬਾਰ ਬਾਰ ਅੰਤਰਰਾਸ਼ਟਰੀ ਲੈਵਲ 'ਤੇ ਵੀ ਆਪਣੇ ਜਿਹੜੇ ਸਮਾਨ ਅਤੇ ਬਿਜ਼ਨਸਸ ਨੂੰ ਗਰੋ ਕਰ ਰਹੇ ਹਨ ਕਈ ਪੰਜਾਬੀ ਹਨ ਜਿਹੜੇ ਆਪਣੇ ਇੱਥੋਂ ਬਿਜਨਸ ਸਟਾਰਟ ਕਰਕੇ ਆਪਣਾ ਵਿਦੇਸ਼ਾਂ 'ਚ ਸਮਾਨ ਭੇਜਦੇ ਹਨ ਅਤੇ ਉੱਥੋਂ ਡਾਲਰ ਵਗੈਰਾ ਕਮਾ ਕੇ ਜਿਹੜਾ ਰੈਮੀਟੈਂਸਸ ਹੈਗੇ ਆਪਣੇ ਪੰਜਾਬ ਦੇ ਵਿੱਚ ਲਿਆਉਂਦੇ ਹਨ ਇਸ ਤਰ੍ਹਾਂ ਪੰਜਾਬ ਦੇ ਇਹ ਖੇ ਖੇਤਰੀ ਅਤੇ ਉਦਯੋਗਿਕ ਵਿਕਾਸ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਹਨ